ਮੇਰਾ ਨਾਂ ਰਜੇਸ਼ ਕੁਮਾਰ ਹੈ ਮੈਂ ਫਿਰੋਜਪੁਰ ਕਲਾਂ ਦਾ ਰਹਿਣ ਵਾਲਾ ਹਾਂ ਮੈਂ ਸਰਕਾਰੀ ਸਕੂਲ ਵਿੱਚ ਅਧਿਆਪਕ ਹਾਂ ਮੈਂ ਐੱਮ ਏ ਐੱਮ ਫਿਲ ਪੰਜਾਬੀ ਵਿਸ਼ੇ ਵਿੱਚ ਕੀਤੀ ਹੋਈ ਹੈ ਮੈਨੂੰ ਲਿਖਣ ਦਾ ਬੜਾ ਹੀ ਸ਼ੌਂਕ ਹੈ ਮੈਂ ਕਦੇ ਕਦੇ ਬੜੇ ਵਧੀਆ ਤਰੀਕੇ ਨਾਲ ਲਿਖ ਸਕਦਾ ਹਾਂ ਮੈਂ ਜ਼ਿਆਦਾਤਰ ਕਾਪੀ ਪੈਨ ਦੇ ਨਾਲ ਪੇਜਾਂ 'ਤੇ ਕਾਪੀ 'ਤੇ ਲਿਖਣ ਦਾ ਸ਼ੌਂਕ ਰੱਖਦਾ ਸੀ ਪਰ ਅੱਜ ਸਮੇਂ ਦੇ ਬਦਲਾਵ ਨੇ ਮੈਨੂੰ ਇਹ ਬਦਲ ਦਿੱਤਾ ਹੈ ਕਿ ਮੈਂ ਮੋਬਾਈਲ ਵਿੱਚ ਟਾਈਪ ਕਰਕੇ ਉਹ ਵੀ ਲਿਖ ਲੈਂਦਾ ਹਾਂ ਕਿਉਂਕਿ ਅੱਜ ਦਾ ਦੌਰ ਬੜਾ ਹੀ ਵਧੀਆ ਹੈ ਅਤੇ ਬੜਾ ਹੀ ਐਡਵਾਂਸ ਟੈਕਨਾਲੋਜੀ ਦੇ ਨਾਲ ਨਾਲ ਚਲਦਾ ਆ ਰਿਹਾ ਹੈ ਜਿਸ ਵਿੱਚ ਮੈਂ ਬੜੇ ਹੀ ਵਧੀਆ ਤਰੀਕੇ ਨਾਲ ਇਸ ਵਿੱਚ ਟਾਈਪ ਕਰਕੇ ਅਤੇ ਉਸਨੂੰ ਲਿਖ ਲੈਂਦਾ ਹਾਂ ਸਭ ਤੋਂ ਪਹਿਲਾਂ ਮੈਂ ਇਹ ਬੜੇ ਹੀ ਵਧੀਆ ਤਰੀਕੇ ਨਾਲ ਲਿਖਣਾ ਜਾਂਚ ਸਿੱਖਣ ਵਾਸਤੇ ਅੰਸ਼ਲ ਨੂੰ ਪੁੱਛਿਆ ਕਿ ਕਿਸ ਤਰ੍ਹਾਂ ਲਿਖਿਆ ਜਾਵੇ ਫਿਰ ਉਹਨੇ ਮੈਨੂੰ ਸਮਝਾਇਆ ਅਤੇ ਮੈਂ ਉਸ ਨੂੰ ਲਿਖਣ ਦਾ ਜਿਹੜਾ ਕੰਮ ਜਿਹੜਾ ਸੀ ਸਿੱਖਿਆ ਅਤੇ ਅੱਜ ਮੈਨੂੰ ਬੜਾ ਹੀ ਆਨੰਦ ਮਿਲਦਾ ਹੈ ਮੈਂ ਫਰੀ ਮਾਇੰਡ ਵਿੱਚ ਇਹ ਲਿਖ ਕੇ ਨਾਲ ਆਪਣੇ ਫੋਨ ਨੂੰ ਨਾਲ ਰੱਖਦਾ ਹਾਂ ਅਤੇ ਪੰਜਾਬੀ ਵਿੱਚ ਟਾਈਪ ਕਰ ਲੈਂਦਾ ਹਾਂ ਕਿਉਂਕਿ ਸਮੇਂ ਦੇ ਲਿਹਾਜ ਨਾਲ ਟਾਈਮ ਟੂ ਟਾਈਮ ਸਾਨੂੰ ਬਦਲਣਾ ਵੀ ਚਾਹੀਦਾ ਅਤੇ ਬਦਲ ਬਦਲਿਆ ਜਾ ਸਕਦਾ ਹੈ ਕਿਉਂਕਿ ਮੈਂ ਕਈ ਚੀਜ਼ਾਂ ਇਸ ਵਿੱਚ ਸੰਭਾਲ ਕੇ ਰੱਖੀਆਂ ਹਨ ਜਿਸ ਤਰਾਂ ਇੱਕ ਵਾਰ ਮੈਂ ਲਿਖਿਆ ਸੀ ਅਲਫ ਆਖ ਸਖੀ ਸਿਆਲਕੋਟ ਅੰਦਰ ਪੂਰਨ ਪੁੱਤ ਸਲਵਾਨ ਦੇ ਜਾ ਆਈ ਜਦੋਂ ਜੰਮਿਆ ਰਾਜੇ ਨੂੰ ਖਬਰ ਹੋਈ ਸੱਤ ਪੰਡਤਾਂ ਵੇਦ ਪੜ੍ਹਾ ਆਈ ਬਾਰ੍ਹਾਂ ਬਰਸਨਾਂ ਰਾਜਿਆਂ ਮੂੰਹ ਲੱਗੀ ਸੱਤ ਪੰਡਤਾਂ ਇਹ ਫਰਮਾਇਆ ਈ ਇਸ ਤਰ੍ਹਾਂ ਦੀਆਂ ਸਤਾਰ੍ਹਾਂ ਜਾਂ ਇਸ ਤਰਾਂ ਦੀ ਪੋਇਟਰੀ ਨੂੰ ਲਿਖ ਕੇ ਮੈਂ ਇਸ ਵਿੱਚ ਟਾਈਪ ਕਰ ਲੈਂਦਾ ਹਾਂ ਅਤੇ ਸਮਾਂ ਮਿਲਣ 'ਤੇ ਉਸਨੂੰ ਪੇਸ਼ ਕਰ ਦਿੰਦਾ ਹਾਂ ਜੋ ਕਿ ਮੈਂ ਪਹਿਲਾਂ ਇੱਕ ਕਾਪੀ ਪੈਨ ਲੈ ਕੇ ਉਸ ਉੱਤੇ ਹੱਥ ਨਾਲ ਲਿਖਾਈ ਕਰਦਾ ਸੀ ਪਰ ਅੱਜ ਦੇ ਦੌਰ ਨੂੰ ਇਹ ਬਦਲ ਕੇ ਮੈਂ ਬੜਾ ਹੀ ਵਧੀਆ ਤਰੀਕਾ ਕਰ ਦਿੱਤਾ ਹੈ